ਪੁਰਾਣੇ ਸਮਿਆਂ ਵਿੱਚ ਲੋਕਾਂ ਨੂੰ ਇਸ ਚੀਜ਼ ਬਾਰੇ ਇੰਨੀ ਨੋਲਜ ਨਹੀਂ ਸੀ ਹੁੰਦੀ ਉਦੋਂ ਮਤਲਬ ਕਿ ਲੋਕਾਂ ਨੂੰ ਜਦੋਂ ਲੋਕਾਂ ਦੇ ਘਰ ਕੁੜੀ ਹੁੰਦੀ ਸੀ ਨਾ ਤਾਂ ਉਹ ਕਹਿੰਦੇ ਸੀ ਨਹੀਂ ਸਾਨੂੰ ਮੁੰਡਾ ਹੀ ਚਾਹੀਦਾ ਜਿਹਦੇ ਕਰਕੇ ਕਿ ਉਹ ਵਾਰ ਵਾਰ ਇਹ ਚੀਜ਼ ਨੂੰ ਕਰਦੇ ਸੀਗੇ ਜਿਹਦੇ ਨਾਲ ਉਹਨਾਂ ਨੂੰ ਜਿਹਦੇ ਲਿੰਗ ਉਤਪਾਦ ਕਰਦੇ ਸੀਗੇ ਜਿਹਦੇ ਕਰਕੇ ਕਿ ਉਹਨਾਂ ਦੇ ਘਰ ਬੱਚੇ ਹੁੰਦੇ ਰਹਿੰਦੇ ਸੀ ਉਹਨਾਂ ਦੇ ਘਰ ਕੁੜੀ ਭਾਵੇਂ ਇੱਕ ਹੋ ਗਈ ਦੋ ਹੋ ਗਈ ਤਿੰਨ ਹੋ ਗਈ ਬਟ ਫਿਰ ਵੀ ਉਹਨਾਂ ਨੇ ਟਰਾਈ ਕਰੀ ਜਾਣਾ ਕਰੀ ਜਾਣਾ ਕਿ ਸਾਡੇ ਘਰ ਮੁੰਡਾ ਹੋ ਵੀ ਹੀ ਜਾਵੇ ਜਿਹਦੇ ਕਰਕੇ ਕਿ ਜਨਸੰਖਿਆ ਜ਼ਿਆਦਾ ਵੱਧਦੀ ਸੀਗੀ ਅਤੇ ਲੋਕਾਂ ਨੂੰ ਇੰਨੀ ਦਿਮਾਗ ਨਹੀਂ ਸੀ ਹੁੰਦਾ ਉਹਨਾਂ ਨੂੰ ਕਿ ਸਾਨੂੰ ਅਸੀਂ ਸਾਨੂੰ ਪ੍ਰੇਟੈਕ ਪ੍ਰੋਟੈਕਸ਼ਨ ਕਰਨ ਦੀ ਜ਼ਰੂਰਤ ਆ ਉਹਨਾਂ ਨੂੰ ਇਹ ਚੀਜ਼ ਸਮਝਾਈ ਨਹੀਂ ਸੀ ਜਾਂਦੀ ਕਿਉਂਕਿ ਉਦੋਂ ਪੜ੍ਹਾਈ ਵੀ ਇੰਨੀ ਉਦੋਂ ਆਪਣੀ ਨੌਲੇਜ ਇੰਨੀ ਜ਼ਿਆਦਾ ਵੱਧ ਨਹੀਂ ਚੁੱਕੀ ਸੀਗੀ ਕਿ ਲੋਕਾਂ ਨੂੰ ਜਾ ਕੇ ਸਮਝਾਇਆ ਜਾਵੇ ਅੱਜ ਕੱਲ੍ਹ ਦੇ ਤਾਂ ਥਾਂ ਥਾਂ 'ਤੇ ਮਤਲਬ ਕਿ ਸਕੂਲਸ ਵਿੱਚ ਵੀ ਸਮਝਾਇਆ ਜਾਂਦਾ ਆ ਇਹ ਚੀਜ਼ਾਂ ਸਮਝਾਈਆਂ ਜਾਂਦੀਆਂ ਵਾ ਲੈਸਨਸ ਹੁੰਦੇ ਆ ਜਿਨ੍ਹਾਂ ਨਾਲ ਕਿ ਲੋਕਾਂ ਨੂੰ ਸਮਝ ਲੱਗਦੀ ਹੈ ਕਿ ਹਾਂ ਵੀ ਇਹ ਚੀਜ਼ ਇੱਦਾਂ ਹੈ ਪੁਰਾਣੇ ਸਮਿਆਂ ਵਿੱਚ ਇਹ ਚੀਜ਼ਾਂ ਨਹੀਂ ਨਾ ਹੁੰਦੀਆਂ ਸੀ ਜਿਨ੍ਹਾਂ ਕਰਕੇ ਕਿ ਆਪਣੀ ਜਨਸੰਖਿਆ ਵੱਧਦੀ ਸੀਗੀ ਨਾਲੇ ਵੀ ਕੁੜੀ ਨੂੰ ਵੈਸੇ ਵੀ ਇੰਨਾ ਮਾਨ ਨਹੀਂ ਸੀ ਦਿੱਤਾ ਜਾਂਦਾ ਜਦੋਂ ਉਹ ਹੁੰਦੀ ਸੀ ਉਹਨਾਂ ਨੂੰ ਹੁੰਦਾ ਸੀ ਕਿ ਅਸੀਂ ਮੁੰਡਾ ਜੰਮੀਏ ਅਸੀਂ ਮੁੰਡਾ ਹੀ ਜੰਮਣਾ ਆ ਜਿਹਦੇ ਕਰਕੇ ਕਿ ਬਹੁਤ ਮੁਸ਼ਕਲਾਂ ਆਉਂਦੀਆਂ ਸੀ ਕੁੜੀ ਨੂੰ ਵੀ ਬੜੀਆਂ ਮੁਸ਼ਕਲਾਂ ਆਉਂਦੀਆਂ ਸੀਗੀਆਂ ਵਾਰ ਵਾਰ ਇਹ ਚੀਜ਼ ਕਰਨੀ ਅਤੇ ਕਈਆਂ ਨੂੰ ਤਾਂ ਬਹੁਤ ਮਤਲਬ ਕਿ ਉਹਨਾਂ ਨੂੰ ਇਹ ਚੀਜ਼ ਦਾ ਨੋਲੇਜ ਨਹੀਂ ਸੀ ਹੁੰਦੀ ਕਿ ਹਾ ਸਾਡੇ ਲਈ ਪ੍ਰੋਟੈਕਸ਼ਨ ਜ਼ ਜ਼ਰੂਰਤ ਕਰਨ ਕਿੰਨਾ ਜ਼ਰੂਰੀ ਆ ਸਾਡੇ ਲਈ ਪ੍ਰੋਟੈਕਸ਼ਨ ਨੂੰ ਜੁ ਜ਼ਰੂਰਤ ਕਰਨਾ ਉਦੋਂ ਲੋਕਾਂ ਕੋਲ ਇੰਨੀ ਦਿਮਾਗ ਨਹੀਂ ਸੀ ਹੁੰਦਾ ਇੰਨਾ ਮਾਈਂਡ ਨਹੀਂ ਸੀ ਸ਼ਾਰਪ ਹੁੰਦਾ ਲੋਕਾਂ ਦਾ ਕਿ ਇਸ ਚੀਜ਼ ਨਾਲ ਗਲਤ ਪ੍ਰਭਾਵ ਵੀ ਪੈ ਸਕਦਾ ਹੈ ਜਿਹਦੇ ਕਰਕੇ ਕਿ ਜਨਸੰਖਿਆ ਵਧੀ ਸੀ ਅਤੇ ਹੁਣ ਅੱਜ ਕੱਲ੍ਹ ਦੇ ਲੋਕਾਂ ਨੂੰ ਤਾਂ ਸਾਰਿਆਂ ਨੂੰ ਨੋਲੇਜ ਆ ਇਸ ਕਰਕੇ ਕਿ ਆਬਾਦੀ ਘੱਟਦੀ ਆ ਆਪਣੇ ਵੈਸੇ ਮੈਨੇ ਜਦੋਂ ਕਹਿੰਦੇ ਆ ਕਿ ਪੁਰਾਣੇ ਜੰਮਿਆਂ ਸਮਿਆਂ ਵਿੱਚ ਲੋਕ ਵਿਹਲੇ ਜ਼ਿਆਦਾ ਹੁੰਦੇ ਸੀਗੇ ਜਿਨ੍ਹਾਂ ਕਰਕੇ ਕਿ ਉਹਨਾਂ ਨੂੰ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਮਤਲਬ ਕਿ ਸੋਚਦੀ ਸੁੱਝਦੀ ਨਹੀਂ ਸੀਗੀ ਜਿਨ੍ਹਾਂ ਕਰਕੇ ਕਿ ਉਹ ਇਹੀ ਕਰਦੇ ਰਹਿੰਦੇ ਸੀਗੇ ਜਿਨ੍ਹਾਂ ਕਰਕੇ ਕਿ ਜਨਸੰਖਿਆ ਆਪਣੀ ਵੱਧਦੀ ਸੀਗੀ ਪਹਿਲਾਂ ਆਬਾਦੀ ਵੱਧਦੀ ਸੀਗੀ